ਕੁਝ ਆਮ ਚੁਣੌਤੀਆਂ ਜਾਂ ਸਮੱਸਿਆਵਾਂ ਜੋ ਕਿ ਆਮ ਲੋਕਾਂ ਨੂੰ ਰੋਜ਼ਾਨਾ ਦੇ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਜ਼ਿਲ੍ਹੇ ਵਿੱਚ ਇੰਡਸਟਰੀ ਦਾ ਨਾ ਹੋਣਾ ਮੁੱਖ ਤੌਰ 'ਤੇ ਜ਼ਿਆਦਾ ਇੰਡਸਟਰੀ ਗੋਬਿੰਦਗੜ੍ਹ ਵਿੱਚ ਹੈ ਅਤੇ ਉਹ ਵੀ ਲੋਹੇ ਨਾਲ ਸੰਬੰਧਿਤ ਹੀ ਹੈ ਹੋਰ ਕੋਈ ਇੰਡਸਟਰੀ ਜ਼ਿਲ੍ਹੇ ਵਿੱਚ ਜ਼ਿਆਦਾ ਨਹੀਂ ਹੈ ਜਿਸ ਕਰਕੇ ਜ਼ਿਆਦਾਤਰ ਲੋਕਾਂ ਨੂੰ ਕੰਮ ਕਰਨ ਲਈ ਆਪਣੇ ਰੋਜ਼ੀ ਰੋਟੀ ਤੋਰਨ ਲਈ ਬਾਹਰਲੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ ਜੋ ਕਿ ਇਹ ਮੇਨ ਸਮੱਸਿਆ ਹੈ ਇਸ ਤੋਂ ਇਲਾਵਾ ਲੋਕਾਂ ਦੀ ਸਿਹਤ ਨੂੰ ਦੇਖਿਆ ਜਾਵੇ ਤਾਂ ਸਿਹਤ ਪੱਖ ਨੂੰ ਦੇਖਦੇ ਹੋਏ ਕੋਈ ਵਧੀਆ ਹਸਪਤਾਲ ਜ਼ਿਲ੍ਹੇ ਵਿੱਚ ਨਹੀਂ ਹੈ ਜੋ ਕਿ ਸਰਕਾਰੀ ਹਸਪਤਾਲ ਜ਼ਿਲ੍ਹੇ ਵਿੱਚ ਹੈ ਉਹ ਵੀ ਸਹੂਲਤਾਂ ਦੀ ਘਾਟ ਹੋਣ ਕਾਰਨ ਲੋਕਾਂ ਦੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਪਾ ਰਿਹਾ ਇਸ ਕਰਕੇ ਅਮਰਜੈਂਸੀ ਹਲਾਤਾਂ ਵਿੱਚ ਮਰੀਜ਼ਾਂ ਨੂੰ ਦੂਸਰੇ ਸ਼ਹਿਰਾਂ ਵਿੱਚ ਲੈ ਕੇ ਜਾਣਾ ਪੈਂਦਾ ਬਾਕੀ ਸ਼ਹਿਰ ਦੀਆਂ ਵੱਡੀਆਂ ਮਠਿਆਈਆਂ ਜੋ ਕਿ ਮਿਠਾਈ ਦੀਆਂ ਦੁਕਾਨਾਂ ਜੋ ਕਿ ਡੁਪਲੀਕੇਟ ਖੋਆ ਵਗੈਰਾ ਵੇਚਦੀਆਂ ਨੇ ਉਹਨਾਂ ਨੂੰ ਚੈੱਕ ਕਰਨ ਦੀ ਲੋੜ ਹੈ ਸਿਹਤ ਵਿਭਾਗ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹਨਾਂ 'ਤੇ ਛਾਪਾਮਾਰੀ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਣ ਦਿੱਤਾ ਜਾਵੇ ਬਾਕੀ ਜ਼ਿਲ੍ਹੇ ਵਿੱਚ ਕਿੰ ਰੇਲਵੇ ਫਾਟਕ ਅਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਨੇ ਜੋ ਕਿ ਆਪਣੇ ਡਿਊਟੀ 'ਤੇ ਜਾਣਾ ਹੋਵੇ ਤਾਂ ਟਾਈਮ ਨਾਲ ਨਹੀਂ ਪਹੁੰਚ ਸਕਦੇ ਬਾਕੀ ਸਭ ਤੋਂ ਇੱਕ ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹਾਂ ਦਾ ਪਾਣੀ ਸ਼ਹਿਰ ਵਿੱਚ ਵੜਦਾ ਹੈ ਜਿਸ ਨੂੰ ਕਿ ਮੁੱਖ ਤੌਰ 'ਤੇ ਦੇਖਣ ਦੀ ਲੋੜ ਹੈ ਅਸੀਂ ਲੀਡਰਾਂ ਨੂੰ ਇਲਾਕੇ ਦੇ ਜੋ ਲੀਡਰ ਹਨ ਇਹੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਸਮੱਸਿਆ ਨੂੰ ਮੁੱਖ ਤੌਰ 'ਤੇ ਦੇਖਿਆ ਜਾਵੇ ਤਾਂ ਜੋ ਲੋਕ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕ ਸਕਣ